ਕ੍ਰਿਕਟ ਇੱਕ ਐਸੀ ਗੇਮ ਹੈ ਜਿਸ ਦੀ ਮੈਂ ਆਪਣੀ ਸਮੱਗਰੀ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਮੈਂ ਅਤੇ ਮੇਰੇ ਦੋਸਤ ਜਦ ਅਸੀਂ ਗਲੀ ਆਪਣੀ ਗਲੀ ਵਿੱਚ ਕ੍ਰਿਕਟ ਖੇਡਿਆ ਕਰਦੇ ਸਨ ਸੀ ਅਸੀਂ ਛੋਟੇ ਸੀ ਅਤੇ ਸਾਡੇ ਕੋਲ ਜਗ੍ਹਾ ਵੀ ਘੱਟ ਸੀ ਸਾਡੇ ਕੋਲ ਇੱਕ ਪੂਰੇ ਗਰਾਊਂਡ ਜਿੰਨੀ ਜਗ੍ਹਾ ਤਾਂ ਨਹੀਂ ਸੀਗੀ ਪਰ ਅਸੀਂ ਜਿੰਨਾ ਉਸ ਦਾ ਇਸਤੇਮਾਲ ਹੋ ਸਕਦਾ ਸੀ ਅਸੀਂ ਉਹ ਕੋਸ਼ਿਸ਼ ਕੀਤੀ ਜਿੱਦਾਂ ਕਿ ਅਸੀਂ ਘ ਘੱਟ ਜਗ੍ਹਾ ਉੱਤੇ ਹੀ ਖੇਡਦੇ ਸੀ ਤਾਂ ਬੋਲ ਅਗਰ ਕਿਸੇ ਦੇ ਘਰ ਚਲੀ ਜਾਂਦੀ ਤਾਂ ਉਸਨੂੰ ਆਊਟ ਮੰਨਿਆ ਜਾਂਦਾ ਸੀਗਾ ਅਤੇ ਛੱਕੇ ਅਤੇ ਚੌਕੇ ਵੀ ਅਸੀਂ ਘ ਨੇੜੇ ਹੀ ਬਾਊਂਡਰੀ 'ਤੇ ਰੱਖੇ ਹੋਏ ਸਨ ਅਗਰ ਕਿਸੇ ਦੀ ਕੰਧ ਉੱਤੇ ਵੱਜਦਾ ਤਾਂ ਉੱਥੇ ਛੱਕਾ ਅਗਰ ਰੁੜ ਕੇ ਬੋਲ ਜਾਂਦੀ ਤਾਂ ਉੱਥੇ ਚੌਕਾ ਬਸ ਇਸ ਤਰ੍ਹਾਂ ਅਸੀਂ ਆਪਣੀ ਗਲੀ ਕ੍ਰਿਕਟ ਖੇਡਿਆ ਕਰਦੇ ਸੀ